ਦਸ ਦਸੰਬਰ ਉੱਨੀ ਸੌ ਉੱਨੀ ਪੰਜ ਜਨਵਰੀ ਉੱਨੀ ਸੌ ਵੀਹ ਦਸ ਮਾਰਚ ਉੱਨੀ ਸੌ ਇੱਕੀ ਦ ਦਸ ਅਪ੍ਰੈਲ ਉੱਨੀ ਸੌ ਬਾਈ ਪੰ ਪੰਜ ਜੂਨ ਉੱਨੀ ਸੌ ਤੇਈ